ਹਾਂ ਮੈਂ ਹਰ ਰੋਜ਼ ਸਵੇਰੇ ਅਤੇ ਸ਼ਾਮ ਦੌੜਨ ਜਾਂਦਾ ਹਾਂ ਮੈਂ ਦੌੜਨ ਵਿੱਚ ਕਾਫ਼ੀ ਸਮਾਂ ਬਤੀਤ ਕਰਦਾ ਹਾਂ ਮੈਨੂੰ ਲਗਭਗ ਡੇਢ ਜਾਂ ਦੋ ਘੰਟੇ ਦੌੜਦੇ ਦੌੜਦੇੇ ਲੱਗ ਹੀ ਜਾਂਦੇ ਹਨ ਇੰਨਾ ਕੁ ਟਾਈਮ ਮੈਂ ਹਰ ਰੋਜ਼ ਆਪਣੀ ਦੋੜਾਂ ਨੂੰ ਦਿੰਦਾ ਹਾਂ ਮੈਨੂੰ ਕਈ ਚੀਜ਼ਾਂ ਪ੍ਰੇਰਿਤ ਕਰਦੀਆਂ ਹਨ ਦੌੜਨ ਲਈ ਜਿਵੇਂ ਕਿ ਕਈ ਮੇਰੇ ਦੋਸਤ ਵੀ ਮੈਨੂੰ ਰੋਜ਼ ਕਹਿੰਦੇ ਹਨ ਕਿ ਅੱਜ ਅਸੀਂ ਦੌੜਨਾ ਹੀ ਦੌੜਨਾ ਹੈ ਅਤੇ ਮੈਂ ਆਪਣੇ ਸਰੀਰ ਵੱਲੋਂ ਵੀ ਤੰਦਰੁਸਤ ਰਹਿਣਾ ਚਾਹੁੰਦਾ ਹਾਂ ਇਸ ਲਈ ਮੈਂ ਹਰ ਰੋਜ਼ ਦੌੜਨ ਜਾਂਦਾ ਹਾਂ